ਮੈਂ ਕੁਝ ਦਿਨਾਂ ਪਹਿਲਾਂ ਹੀ ਅਸੀਂ ਸਾਰੇ ਪਰਿਵਾਰ ਦੇ ਲੋਕ ਇਕੱਠੇ ਬੈਠੇ ਸਾਂ ਉਦੋਂ ਮੇਰੇ ਪਾਪਾ ਜੀ ਨੇ ਅਚਾਨਕ ਹੀ ਇੱਕ ਗੱਲ ਛੇੜ ਲਈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਚਿੱਤ ਕਰਦਾ ਹੈ ਕਿ ਆਪਾਂ ਸਾਰੇ ਹੀ ਬ੍ਰਿੰਦਾਵਨ ਜਾ ਕੇ ਠਾਕੁਰ ਜੀ ਦੇ ਦਰਸ਼ਨ ਕਰੀਏ ਉਹਨਾਂ ਦੀ ਇਹ ਗੱਲ ਸੁਣ ਕੇ ਸਾਰੇ ਪਰਿਵਾਰ ਦੇ ਲੋਕਾਂ ਦੇ ਚਿਹਰੇ 'ਤੇ ਇੱਕ ਰੌਣਕ ਜਿਹੀ ਆ ਗਈ ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਬਹੁਤਾ ਚਿਰ ਹੋ ਗਿਆ ਸੀ ਕਿ ਅਸੀਂ ਕਿੱਥੇ ਘੁੰਮਣ ਵੀ ਨਹੀਂ ਗਏ ਸਾਂ ਇਸ ਕਰਕੇ ਹੁਣ ਸਾਰੇ ਹੀ ਜੁਗਤ ਲਾਉਣ ਲੱਗੇ ਕਿ ਬ੍ਰਿੰਦਾਵਨ ਕਦੋਂ ਅਤੇ ਕਿਸ ਤਰ੍ਹਾਂ ਜਾਣਾ ਹੈ ਪਾਪਾ ਜੀ ਨੇ ਮੈਨੂੰ ਕਿਹਾ ਕਿ ਮੈਂ ਰੇਲਵੇ ਦੀਆਂ ਟਿਕਟਾਂ ਬੁੱਕ ਕਰਾ ਦਿਆਂ ਪਰ ਮੈਨੂੰ ਰੇਲਵੇ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਨਹੀਂ ਆਉਂਦੀਆਂ ਸਨ ਇਸ ਕਰਕੇ ਮੈਂ ਮੇਰੀ ਇੱਕ ਸਹੇਲੀ ਤੋਂ ਇਸ ਬਾਰੇ ਮਦਦ ਮੰਗੀ ਮੇਰੀ ਉਹ ਸਹੇਲੀ ਅਤੇ ਉਸ ਦਾ ਪਰਿਵਾਰ ਹੁਣੇ ਪਿਛਲੇ ਦਿਨੀਂ ਹੀ ਬਾਹਰ ਕਿਸੇ ਸ਼ਹਿਰ ਘੁੰਮਣ ਗਏ ਸਨ ਉਦੋਂ ਮੇਰੀ ਸਹੇਲੀ ਨੇ ਹੀ ਇਹਨਾਂ ਸਾਰੀਆਂ ਦੀਆਂ ਟਿਕਟਾਂ ਬੁੱਕ ਕਰਾਈਆਂ ਸਨ ਅਤੇ ਇਸ ਕਰਕੇ ਮੈਂ ਉਸ ਨੂੰ ਕਿਹਾ ਕਿ ਉਹ ਇਸ ਕੰਮ ਵਿੱਚ ਮੇਰੀ ਵੀ ਮਦਦ ਕਰ ਦਵੇ ਮੈਂ ਉਸ ਨੂੰ ਕਿਹਾ ਕਿ ਉਹ ਸਾਡੀਆਂ ਤੀਹ ਤਰੀਕ ਦੀਆਂ ਫਾਜ਼ਿਲਕਾ ਤੋਂ ਲੈ ਕੇ ਬ੍ਰਿੰਦਾਵਨ ਤੱਕ ਦੀ ਟਿਕਟ ਏਸੀ ਡੱਬੇ ਵਿੱਚ ਬੁੱਕ ਕਰਾ ਦਵੇ ਅਤੇ ਜੇਕਰ ਉਸ ਨੂੰ ਇਸ ਕੰਮ ਲਈ ਮੇਰੀ ਉਪਭੋਗਤਾ ਆਈਡੀ ਪੰਜ ਛੇ ਸੱਤ ਨੌ ਅਤੇ ਪਾਸਵਰਡ ਜ਼ੀਰੋ ਇੱਕ ਛੇ ਚਾਰ ਦੀ ਲੋੜ ਪਵੇ ਅਤੇ ਉਹ ਇਸ ਦੀ ਵਰਤੋਂ ਵੀ ਕਰ ਸਕਦੀ ਹੈ ਮੇਰੀ ਇਸ ਗੱਲ 'ਤੇ ਮੇਰੀ ਸਹੇਲੀ ਨੇ ਬਿਨਾਂ ਟਾਈਮ ਗਵਾਏ ਫਟਾਫਟ ਸਾਡੇ ਸਾਰਿਆਂ ਦੀਆਂ ਟਿਕਟਾਂ ਬੁੱਕ ਕਰਾ ਦਿੱਤੀਆਂ ਤਾਂ ਜੋ ਅਸੀਂ ਫਿਰ ਬ੍ਰਿੰਦਾਵਨ ਜਾ ਪਾਏ ਅਤੇ ਠਾਕੁਰ ਜੀ ਦੇ ਦਰਸ਼ਨ ਕਰ ਪਾਏ